ਨਵਜੰਮੇ ਬੱਚੇ ਨੂੰ ਲੈ ਕੇ ਸਾਡੀਆਂ ਬਹੁਤ ਹੀ ਜ਼ਿਆਦੀਆਂ ਰਿਸਪੋਂਸੀਬਿਲਿਟੀਜ਼ ਹੁੰਦੀਆਂ ਹੈ ਜਿਵੇਂ ਕਿ ਆਪਾਂ ਨੂੰ ਜਦੋਂ ਵੀ ਉਹ ਹੁੰਦਾ ਹੈ ਅਤੇ ਅੱਜ ਕੱਲ੍ਹ ਦੇ ਜਿਹੜੇ ਲੋਕ ਹੁੰਦੇ ਆ ਉਹ ਮਤਲਬ ਕਿ ਇੰਨੀ ਜ਼ਿਆਦਾ ਕੇਅਰ ਨਹੀਂ ਕਰਦੇ ਆਪਣਾ ਬੱਚਾ ਕਿਸੇ ਨੂੰ ਵੀ ਫੜਾ ਦਿੰਦੇ ਆ ਜਿਹਦੇ ਨਾਲ ਮਤਲਬ ਕਿ ਇੱਕ ਦੂਜੇ ਦੇ ਹੱਥ ਲੱਗਦੇ ਰਹਿੰਦੇ ਆ ਉਹਨੂੰ ਜਿਹੜੀ ਬੱਚੇ ਦੀ ਜਿਹੜੀ ਸਕਿਨ ਹੁੰਦੀ ਆ ਉਹ ਬਹੁਤ ਹੀ ਜ਼ਿਆਦਾ ਸੈਂਸਟਿਵ ਹੁੰਦੀ ਹੈ ਮਤਲਬ ਉਹ ਬਹੁਤ ਜ਼ਿਆਦਾ ਅਜੇ ਉਹਨਾਂ ਦਾ ਇਮਿਊਨ ਸਿਸਟਮ ਇੰਨਾ ਜ਼ਿਆਦਾ ਉਹ ਨਹੀਂ ਹੋਇਆ ਹੁੰਦਾ ਸਟਰੋਂਗ ਨਹੀਂ ਹੋਇਆ ਹੁੰਦਾ ਜਿਹਦੇ ਨਾਲ ਉਹ ਮਤਲਬ ਕਿ ਹਰੇਕ ਪ੍ਰੋਬਲਮ ਦੇ ਨਾਲ ਹੇ ਹਰੇਕ ਮਤਲਬ ਬਿਮਾਰੀ ਦੇ ਨਾਲ ਲੜ ਸਕਣ ਅਤੇ ਆਪਣਾ ਮਤਲਬ ਕਿ ਆਪਣੇ ਹੱਥ ਵਿੱਚ ਆਪਣੇ ਲਿਪਸ ਦੇ ਵਿੱਚ ਕਿ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹੈ ਜਿੱਦਾਂ ਆਪਾਂ ਬਾਹਰੋਂ ਆਉਂਦੇ ਹਾਂ ਆਪਾਂ ਆਉਂਦਿਆ ਸਾਰ ਹੀ ਆਪਣੇ ਬੱਚੇ ਨੂੰ ਕਿਸ ਕਰ ਦਿੰਦੇ ਹਾਂ ਉਹਨਾਂ ਨੂੰ ਹੱਥ ਲਗਾ ਦਿੰਦੇ ਹਾਂ ਅਤੇ ਸਾਡੀਆਂ ਜਿਹੜੀਆਂ ਬਿਮ ਮਤਲਬ ਕਿ ਸਾਡੇ ਜਿਹੜੇ ਕੀਟਾਣੂ ਹੁੰਦੇ ਆ ਉਹ ਬੱਚੇ ਨੂੰ ਲੱਗ ਜਾਂਦੇ ਆ ਜਿਹਦੇ ਨਾਲ ਬੱਚਾ ਬੜੀਆਂ ਜ਼ਿਆਦੀਆਂ ਮਤਲਬ ਕਿ ਪ੍ਰੋਬਲਮ ਉਹਨੂੰ ਫੇਸ ਕਰਦਾ ਜਿਵੇਂ ਕਿ ਅੱਜ ਕੱਲ੍ਹ ਦੇ ਲੋਕ ਹੁੰਦੇ ਆ ਉਹ ਆਪਣੇ ਬੱਚੇ ਨੂੰ ਕਿਸੇ ਨੂੰ ਵੀ ਫੜਾ ਦਿੰਦੇ ਆ ਕਿਸੇ ਨੂੰ ਕੇਅਰ ਕਰਨ ਨੂੰ ਦੇ ਦਿੰਦੇ ਆ ਮਤਲਬ ਵੱਖ ਮੇਡ ਰੱਖ ਲੈਂਦੇ ਆ ਬੱਚੇ ਵਾਸਤੇ ਜਿਹਦੇ ਨਾਲ ਉਹ ਮੇਡ ਵੀ ਇੰਨਾ ਜ਼ਿਆਦਾ ਮਤਲਬ ਕਿ ਧਿਆਨ ਨਹੀਂ ਰੱਖ ਪਾਉਂਦੀ ਜਿਹਦੇ ਨਾਲ ਉਹ ਬੱਚਾ ਵੀ ਬੇਚਾਰਾ ਮਤਲਬ ਕਿ ਕਾਫੀ ਜ਼ਿਆਦਾ ਕਈ ਵਾਰੀ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਪ੍ਰੋਬਲਮਸ ਹੋ ਜਾਂਦੀਆਂ ਹੈ ਜਿਹੜੀਆਂ ਮਤਲਬ ਕਿ ਉਹਨਾਂ ਨੂੰ ਸਾਰੀ ਉਮਰ ਨਹੀਂ ਲੱਥਦੀਆਂ ਆਪਾਂ ਨੂੰ ਅਗਰ ਮਤਲਬ ਆਪਣੇ ਘਰ ਵਿੱਚ ਬੱਚਾ ਬੈਠਾ ਹੈ ਇੱਕ ਰੂਮ ਵਿੱਚ ਹੈ ਉਹ ਰੂਮ ਨੂੰ ਮਤਲਬ ਨੀਟ ਐਂਡ ਕਲੀਨ ਰੱਖਣਾ ਚਾਹੀਦਾ ਹੈ ਉਹਨੂੰ ਸਾਫ ਸੁਥਰਾ ਬਣਾਉਣਾ ਚਾਹੀਦਾ ਹੈ ਉਹਨਾਂ ਉੱਥੇ ਸੈਨੀਟਾਈਜ਼ਰ ਯੂਜ ਕਰਨਾ ਚਾਹੀਦਾ ਹੈ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ ਮਤਲਬ ਮੰਮਾ ਨੂੰ ਵੀ ਦੁੱਧ ਪਿਆਉਣ ਤੋਂ ਪਹਿਲਾਂ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਬੱਚੇ ਦੀ ਜਿਹੜੀ ਚੀਜ਼ ਆ ਉਹਨੂੰ ਫਰੈਸ਼ ਬੋਇਲਡ ਰੱਖਣਾ ਚਾਹੀਦਾ ਹੈ ਮਤਲਬ ਉਹਦੀ ਜਿਹੜੀ ਬੋਟਲ ਹੋਊਗੀ ਉਹਦੇ ਜਿਹੜੀ ਜੇ ਅਗਰ ਤੁਸੀਂ ਉਹਨੂੰ ਕੋਈ ਦਵਾਈ ਦੇਣ ਦਿਓ ਬਹੁਤ ਹੀ ਵਧੀਆ ਤਰੀਕੇ ਨਾਲ ਦੇਣੀ ਚਾਹੀਦੀ ਹੈ ਡਾਕਟਰ ਨੂੰ ਕੰਸਰਨ ਕਰਨਾ ਚਾਹੀਦਾ ਹੈ ਅਤੇ ਮਤਲਬ ਕਿ ਜਿ ਛੋਟੇ ਬੱਚਿਆਂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਕਿਊਰੀਅਸ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੇ ਬੱਚੇ ਹੁੰਦੇ ਆ ਉਹ ਇੱਕ ਬਹੁਤ ਹੀ ਸੋਫਟ ਹਾਰਟਡ ਦੇ ਸੋਫਟ ਪਰਸਨ ਹੁੰਦੇ ਆ ਜਿਹਦੇ ਨਾਲ ਮਤਲਬ ਉਹਨਾਂ ਨੂੰ ਬੜੀ ਛੇਤੀ ਬਿਮਾਰੀਆਂ ਲੱਗ ਜਾਂਦੀਆਂ ਅਤੇ ਆਪਾਂ ਨੂੰ ਉਹਨਾਂ ਨੂੰ ਉਸ ਬਿਮਾਰੀਆਂ ਤੋਂ ਬਚਾਉਣਾ ਚਾਹੀਦਾ ਕਿਉਂਕਿ ਗਾਹਾਂ ਜਾ ਕੇ ਉਹਨਾਂ ਨੂੰ ਬੜੀਆਂ ਜ਼ਿਆਦੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਕਈ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਛੋਟੇ ਹੁੰਦੇ ਤੋਂ ਲੱਗ ਜਾਂਦੀਆਂ ਜਿਹੜੀਆਂ ਗਾਹਾਂ ਜਾ ਕੇ ਵੀ ਉਹਨਾਂ ਦਾ ਖਹਿੜਾ ਨਹੀਂ ਛੱਡਦੀਆਂ